ਇੱਕ ਜਨਵਰੀ ਦੋ ਹਜ਼ਾਰ ਛੇ ਪੰਜ ਫਰਵਰੀ ਦੋ ਹਜ਼ਾਰ ਸੱਤ ਗਿਆਰਾਂ ਨਵੰਬਰ ਦੋ ਹਜ਼ਾਰ ਗਿਆਰਾਂ ਚੌਦਾਂ ਨਵੰਬਰ ਦੋ ਹਜ਼ਾਰ ਦਸ ਬਾਰ੍ਹਾਂ ਨਵੰਬਰ ਦੋ ਹਜ਼ਾਰ ਬਾਰ੍ਹਾਂ